ਅਸੀਂ ਆਪਾਂ ਆਪਣੇ ਇਲਾਕੇ ਦੇ ਆਲੇ ਦੁਆਲੇ ਵੇਖਦੇ ਹਾਂ ਕਿ ਵੀ ਕਿਤੇ ਬ ਬਹੁਤ ਜ਼ਿਆਦਾ ਬੇਰੁਜ਼ਗਾਰੀ ਹੈਗੀ ਹੈ ਅਤੇ ਗਰੀਬੀ ਵੀ ਹੈਗੀ ਹੈ ਬੇਰੁਜ਼ਗਾਰੀ ਕਾਰਨ ਹੀ ਗਰੀਬੀ ਹੈ ਜੇ ਕੰਮ ਹੀ ਨਹੀਂ ਹੋਵੇਗਾ ਤਾਂ ਲੋਕ ਗਰੀਬ ਹੀ ਹੋਣਗੇ ਤੇ ਜ ਆਪਾਂ ਆਪਣੇ ਆਲੇ ਦੁਆਲੇ ਸਲੀਮਸ ਏਰੀਆ ਹੈਗੇ ਜਿਵੇਂ ਝੁੱਗੀ ਝੌਂਪੜੀਆਂ ਵਾਲੇ ਆ ਉਹਨਾਂ ਕੋਲ ਕੋਈ ਕੰਮ ਨਹੀਂ ਹੁੰਦਾ ਫਿਰ ਕੰਮਕਾਰ ਨਹੀਂ ਹੁੰਦਾ ਲੋਕ ਨਸ਼ਿਆਂ 'ਚ ਵੀ ਪੈ ਜਾਂਦੇ ਨੇ ਇਹ ਲੋਕ ਨਸ਼ਿਆਂ 'ਚ ਪੈ ਜਾਂਦੇ ਆ ਤਾਂ ਫਿਰ ਇਹ ਗਲਤ ਕੰਮਾਂ 'ਚ ਹੋ ਜਾਂਦੇ ਉਹਦੇ ਕਰਕੇ ਅਪਰਾਧ ਵੱਧਦਾ ਹੈਗਾ ਕੋਈ ਨਸ਼ੇ ਕਰਦਾ ਤਾਂ ਚੋਰੀਆਂ ਚਕਾਰੀਆਂ ਕਰਦੇ ਹੈਗੇ ਆ ਜਾਂ ਲੁੱਟਮਾਰ ਕਰਦੇ ਹੈ ਆਪਾਂ ਆਪਣੇ ਆਲੇ ਦੁਆਲੇ ਕੋਈ ਵਾਤਾਵਰਨ ਅੱਜ ਕੱਲ੍ਹ ਸੁਰਕਸ਼ਿਤ ਨਹੀਂ ਕੋਈ ਕਿੱਧਰ ਜਾ ਰਿਹਾ ਹੁੰਦਾ ਤਾਂ ਫੋਨ ਹੱਥ 'ਚੋਂ ਖਿੱਚ ਕੇ ਲੈ ਗਏ ਜਾਂ ਕਿਸੇ ਦੇ ਕੁਛ ਸੋਨੇ ਚਾਂਦੀ ਦੀ ਚੀਜ਼ ਪਾਈ ਹੁੰਦੀ ਆ ਉਹ ਖਿੱਚ ਕੇ ਲੈ ਜਾਂਦੇ ਹੈਗੇ ਆ ਬਾਈ ਬਹੁਤ ਜ਼ਿਆਦਾ ਅਪਰਾਧ ਇਸ ਕਾਰਨ ਵਧਿਆ ਗਿਆ ਵਧਿਆ ਪਿਆ ਹੈਗਾ ਜੇ ਬੇਰੁਜ਼ਗਾਰੀ ਹੱਟ ਜਾਵੇ ਦੇਸ਼ 'ਚੋਂ ਗਰੀਬੀ ਗਰੀਬੀ ਹਟ ਜਾਵੇ ਤਾਂ ਨਸ਼ੇ ਵੀ ਹ ਨਸ਼ੇ ਵੀ ਖ਼ਤਮ ਹੋਣ ਤਾਂ ਅ ਦੇਸ਼ ਥੋੜ੍ਹਾ ਸੁਰਖਸ਼ਿਤ ਹੋਵੇਗਾ ਇਹਨਾਂ ਚੀਜ਼ਾਂ ਕਰਕੇ ਹੀ ਅਪਰਾਧ ਜ਼ਿਆਦਾ ਵਧੀ ਜਾਂਦਾ ਹੈਗਾ ਹੈ ਆਪਣੇ ਦੇਸ਼ 'ਚ ਇਹ ਧਿਆਨ ਦੇਣ ਦੀ ਲੋੜ ਹੈ ਕਿ ਵੱਧ ਤੋਂ ਵੱਧ ਲੋਕਾਂ ਦੀ ਬੇਰੁਜ਼ਗਾਰੀ ਦੂਰ ਹੋਵੇ ਜੇ ਬੇਰੁਜ਼ਗਾਰੀ ਦੂਰ ਹੋਵੇਗੀ ਤਾਂ ਗਰੀਬੀ ਆਪੇ ਹੀ ਜੇ ਬ ਲਬ ਲੋਕ ਕੰਮ ਕਰਨਗੇ ਤਾਂ ਗਰੀਬੀ ਆਪੇ ਹੀ ਦੂਰ ਹੋਵੇਗੀ ਜੇ ਲੋਕਾਂ ਕੋਲ ਪੈਸਾ ਹੋਵੇਗਾ ਤਾਂ ਅਪਰਾਧ ਵੀ ਘਟਣਗੇ ਉਹ ਚੋਰੀਆਂ ਚਕਾਰੀਆਂ ਤੋਂ ਵੀ ਵ ਮਤਲਬ ਥੋੜ੍ਹਾ ਉਹਨਾਂ ਦਾ ਸੁਧਾਰ ਹੋਵੇਗਾ ਸੁਧਾਰ ਹੋਵੇਗਾ ਉਹਨਾਂ ਦਾ ਇਹ ਆਪਣੇ ਦੇਸ਼ 'ਚ ਅਪਰਾਧ ਇੰਨਾ ਵਧੀਆ ਪਿਆ ਹੈ ਕਿ ਆਪਾਂ ਕਿਤੇ ਜਾਂਦੇ ਹਾਂ ਤਾਂ ਕੋਈ ਪਰਸ ਖਿੱਚ ਕੇ ਲੈ ਗਿਆ ਕੋਈ ਕੁਛ ਖਿੱਚ ਕੇ ਲੈ ਗਿਆ